ਹੈਲੋ ਹਾਂਜੀ ਸੇਨ ਢਾਬੇ ਤੋਂ ਜੀ ਅੱਜ ਦਾ ਮੈਨਿਊ ਕੀ ਆਪਣਾ ਓਕੇ ਠੀਕ ਹੈ ਜੀ ਦਾਲ ਮੱਖਣੀ ਅੱਛਾ ਜੀ ਸ਼ਾਹੀ ਪਨੀਰ ਵੀ ਬਣਾਉਂਦੇ ਹੋ ਓਕੇ ਠੀਕ ਹੈ ਜੀ ਅੱਛਾ ਜੀ ਲੱਛੇ ਪਰੋਂਠੇ ਵੀ ਅੱਛਾ ਜੀ ਨਾਨ ਵੀ ਓਕੇ ਜੀ ਅਤੇ ਫੇਰ ਕਾਫੀ ਫਰੈਂਡਜ਼ ਆਉਂਦੇ ਨੇ ਵੀਰੇ ਤੁਹਾਡੇ ਕੋਲ ਦੱਸਿਆ ਉਨ੍ਹਾਂ ਨੇ ਮੈਨੂੰ ਤੁਹਾਡੇ ਬਾਰੇ ਕਿ ਵਧੀਆ ਚੀਜ਼ ਬਣਾਉਂਦੇ ਹੋ ਟੇਸਟੀ ਹੁੰਦੀ ਹੈ ਜੀ ਤਾਂ ਮੈਂ ਵੀ ਓਡਰ ਕਰਨਾ ਸੀ ਜੀ ਹਾਂ ਹਾਂਜੀ ਸ਼ਾਹੀ ਪਨੀਰ ਕਰ ਦਿਓ ਹਾਂਜੀ ਤੰਦੂਰੀ ਰੋਟੀ ਕਰ ਦਿਓ ਜੀ ਅਤੇ ਮੇਰਾ ਓਡਰ ਹੈਗਾ ਇੱਥੋੇਂ ਆਪਣਾ ਪਾਵਰ ਕਲੋਨੀ ਦਾ ਜੀ ਪੰਜ ਸੌ ਬਾਰ੍ਹਾਂ ਨੰਬਰ ਕੁਆਰਟਰ ਤੋਂ ਜੀ ਜੋ ਡਿਲੀਵਰੀ ਕਰਨ ਆਏਗਾ ਤਾਂ ਉਸ ਦਾ ਮੈਨੂੰ ਨੰਬਰ ਦੇ ਦਿਓ ਤਾਂ ਮੈਂ ਕੋਲ ਕਰਕੇ ਪਤਾ ਕਰ ਲਵਾਂਗਾ ਜੀ ਹਾਂਜੀ ਵੈਸੇ ਉਮੀਦ ਹੈ ਮੈਨੂੰ ਵਧੀਆ ਹੋਏਗਾ ਤੁਹਾਡਾ ਖਾਣਾ ਕਾਫੀ ਫਰ੍ਰੈਂਡਸ ਨੇ ਦੱਸਿਆ ਜੀ ਕਾਫੀ ਨਾਮ ਹੈ ਤੁਹਾਡਾ ਜੀ ਹਾਂਜੀ ਜੀ